ਹਾਂਜੀ ਅੱਜ ਅਸੀਂ ਰਾਤ ਨੂੰ ਕੁਛ ਡਿਨਰ 'ਤੇ ਸਬਜ਼ੀਆਂ ਮੰਗਵਾਉਣ ਦਾ ਜਾਂ ਡਿਨਰ 'ਚ ਕੋਈ ਆਪਣੇ ਸਾਰਾ ਮੈਨਿਊ ਮੰਗਵਾਉਣ ਦਾ ਔਡਰ ਲਈ ਅਸੀਂ ਪਲੈਨ ਕਰ ਰਹੇ ਸੀ ਅਤੇ ਬੈਠੇ ਬੈਠੇ ਮਨ 'ਚ ਖਿਆਲ ਆਇਆ ਵੀ ਸਾਨੂੰ ਕੋਈ ਨਾ ਕੋਈ ਕੂਪਨ ਅਗਰ ਮਿਲ ਜਾਵੇ ਤਾਂ ਸਾਡਾ ਜਿਹੜਾ ਡਿਨਰ ਦਾ ਹੈ ਖਰਚਾ ਉਹ ਥੋੜ੍ਹਾ ਜਿਹਾ ਬਚ ਜਾਵੇ ਕਿਉਂਕਿ ਅੱਜ ਕੱਲ੍ਹ ਮਹਿੰਗਾਈ ਦਾ ਜ਼ਮਾਨਾ ਹੈ ਅਤੇ ਥੋੜ੍ਹੇ ਜਿਹੇ ਕੂਪਨ ਮਿਲਣ ਨਾਲ ਸਾਡਾ ਉਹ ਕੰਮ ਸੌਖਾ ਹੋ ਸਕਦਾ ਹੈ ਅਤੇ ਅਗਾਂਹ ਨੂੰ ਵੀ ਅਸੀਂ ਫਿਰ ਉਹਦਾ ਕੂਪਨ ਦਾ ਯੂਜ਼ ਕਰਕੇ ਅਸੀਂ ਹੋਰ ਵੀ ਕਿਸੇ ਹੋਰ ਦਿਨ ਵੀ ਖਾਣਾ ਮੰਗਾ ਸਕਦੇ ਹਾਂ ਫਿਰ ਅਸੀਂ ਜਾਂਚ ਕਰਦੇ ਕਰਦੇ ਕੰਪਨੀਆਂ ਦੀਆਂ ਵੈਬਸਾਈਟਾਂ ਚੈੱਕ ਕਰੀਆਂ ਸਵੀਗੀ ਚੱਲ ਰਹੀ ਹੈ ਅਤੇ ਜਮੈਟੋ ਹੈ ਹੋਰ ਵੀ ਬੜੀਆਂ ਕੰਪਨੀਆਂ ਨੇ ਜਿਨ੍ਹਾਂ ਦੇ ਅੱਜ ਕੱਲ੍ਹ ਔਨਲਾਈਨ ਔਡਰ 'ਤੇ ਆਪਾਂ ਔਡਰ ਕਰ ਸਕਦੇ ਹਾਂ ਅਤੇ ਇੱਦਾਂ ਹੀ ਅੱਜ ਕੱਲ੍ਹ ਜਿਵੇਂ ਸਵੀਗੀ ਦਾ ਚੱਲ ਰਿਹਾ ਸੀ ਟਰੈਂਡ ਉਹ ਸਾਨੂੰ ਮਿਲ ਗਿਆ ਇੱਕ ਕੂਪਨ ਜਿਹੜਾ ਕਿ ਪੰਜਾਹ ਪ੍ਰਸੈਂਟ ਸਾਨੂੰ ਉੱਥੇ ਕੂਪਨ 'ਤੇ ਛੂਟ ਪ੍ਰਾਪਤ ਹੋਈ ਹੈ ਅਤੇ ਪੰਜਾਹ ਪ੍ਰਸੈਂਟ ਅਸੀਂ ਔਡਰ ਕੀਤਾ ਇਹ ਘੱਟੋ ਘੱਟ ਅਸੀਂ ਪੰਜ ਸੌ ਰੁਪਏ ਦਾ ਡਿਨਰ ਦਾ ਸਮਾਨ ਔਡਰ ਕੀਤਾ ਜਿਹਦੇ ਵਿੱਚ ਖਾਣਾ ਵੀ ਸੀ ਅਤੇ ਸਬਜ਼ੀਆਂ ਵੀ ਸੀ ਅਤੇ ਉਸ 'ਤੇ ਸਾਨੂੰ ਪੰਜਾਹ ਪ੍ਰਸੈਂਟ ਆਫ ਉਹਨਾਂ ਨੇ ਸਾਨੂੰ ਪ੍ਰੋਵਾਈਡ ਕੀਤੀ ਅਤੇ ਪ੍ਰੋ ਉਹਨਾਂ ਨਾਲ ਸਾਡੇ ਨਾਲ ਸਾਡਾ ਦੋ ਢਾਈ ਸੌ ਰੁਪਏ ਦਾ ਖਰਚਾ ਜਿਹੜਾ ਹੈ ਉਹ ਬਚ ਗਿਆ ਅਤੇ ਅਸੀਂ ਉਹਨਾਂ ਨੂੰ ਕੂਪਨ ਦੇਣ ਲਈ ਬਹੁਤ ਧੰਨਵਾਦ ਕੀਤਾ ਅਤੇ ਵੈਬਸਾਈਟ 'ਤੇ ਉਹਨਾਂ ਦੇ ਕੂਪਨ ਉਪਲਬਧ ਸਾਨੂੰ ਮਿਲੇ ਪਾਏ ਗਏ ਅਤੇ ਔਡਰ ਅਸੀਂ ਕਰਕੇ ਫਿਰ ਅਸੀਂ ਖਾਣਾ ਖਾਧਾ ਅਤੇ ਅਸੀਂ ਕੰਪਨੀ ਦਾ ਧੰਨਵਾਦ ਵੀ ਮਨੋ ਮਨ ਕੀਤਾ ਕਿ ਉਹਨਾਂ ਨੇ ਸਾਨੂੰ ਇੰਨਾ ਵਧੀਆ ਕੂਪਨ ਪ੍ਰੋਵਾਈਡ ਕੀਤਾ ਹੈ